ਸਾਡੇ ਨਗਰ 'ਚ ਪੰਜਾਬੀ ਨਾਟਕ ਇਹੋ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ ਜੀ ਵੱਲੋਂ ਰਚਿਤ ਤੀਹ ਮਾਰਚ ਨੂੰ ਪੰਜਾਬੀ ਭਵਨ ਵਿਖੇ ਹੋਣ ਜਾ ਰਿਹਾ ਜਿਸ ਦੀਆਂ ਟਿਕਟਾਂ ਵੇਚਣ ਦੀ ਜ਼ਿੰਮੇਵਾਰੀ ਸਾਡੇ ਮਹਿਕਮੇ ਨੂੰ ਸੌਂਪੀ ਗਈ ਹੈ ਇਸ ਕੰਮ ਲਈ ਮੈਂ ਕੁਝ ਸਹਿਕਰਮੀਆਂ ਨੂੰ ਚੁਣਿਆ ਹੈ ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਜ਼ਿੰਮੇਵਾਰੀ ਤਹਿ ਦਿਲ ਨਾਲੋਂ ਨਿਭਾਓਗੇ ਇਹੋ ਹਮਾਰਾ ਜੀਵਣਾ ਨਾਟਕ ਗਰੀਬੀ ਦੀ ਮਾਰ ਝੱਲਦੀ ਔਰਤ ਦੀ ਦੁੱਖਦਾਈ ਭਰੀ ਜ਼ਿੰਦਗੀ ਨੂੰ ਦਰਸਾਉਂਦਾ ਹੈ ਸਾਰੇ ਸਹਿਕਰਮੀਆਂ ਨੂੰ ਬੇਨਤੀ ਹੈ ਕਿ ਅਠਾਈ ਮਾਰਚ ਤੱਕ ਟਿਕਟਾਂ ਦੀ ਬੁਕਿੰਗ ਨੇਪਰੇ ਚਾੜ੍ਹ ਦਿੱਤੀ ਜਾਵੇ ਤਾਂ ਜੋ ਬੈਠਣ ਦਾ ਪ੍ਰਬੰਧ ਸੁਚਾਰੂ ਰੂਪ ਨਾਲ ਕੀਤਾ ਜਾ ਸਕੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਇਹੋ ਜਿਹੇ ਨਾਟਕ ਦੇਖਣ ਲਈ ਪ੍ਰੇਰਿਤ ਕਰੋ ਜੋ ਸਾਨੂੰ ਜ਼ਿੰਦਗੀ ਦੀਆਂ ਔਕੜਾਂ ਨਾਲ ਲੜਨ ਦੀ ਹਿੰਮਤ ਬਖਸ਼ਦੇ ਹਨ ਅਤੇ ਸਹੀ ਨਿਰਦੇਸ਼ ਕਰਦੇ ਹਨ